ਹਾਂ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਜੀ ਭਾਅ ਜੀ ਮੈਂ ਆਰਡਰ ਮੰਗਵਾਇਆ ਸਵੀਗੀ ਤੋਂ ਮੱਖਣ ਫਿਸ਼ ਤੋਂ ਆਇਆ ਆਰਡਰ ਉਹ ਮੱਛੀ ਮੰਗਵਾਈ ਸੀ ਕੁਆਰਟਰ ਅਤੇ ਉਹ ਭਾਅ ਜੀ ਨਾ ਇੱਕ ਤਾਂ ਬਿਲਕੁਲ ਠੰਡੀ ਹੈ ਜਿੱਦਾਂ ਕੱਲ ਦੀ ਪਈ ਹੋਵੇ ਅਤੇ ਦੂਸਰਾ ਇਹ ਕਿ ਉਹ ਉਹਦੀ ਕੁਆਂਟਿਟੀ ਇੰਨੀ ਘੱਟ ਆ ਅਤੇ ਉਹਦਾ ਬਿਲਕੁਲ ਓਈਲੀ ਆ ਅਸੀਂ ਮੰਗਵਾਈ ਸੰਘਾੜਾ ਫਿਸ਼ ਅਤੇ ਉਹ ਮੈਨੂੰ ਲੱਗਣਾ ਪਿਆਸੀ ਹੈ ਜਿੱਦਾਂ ਉਹਦੇ ਇੰਨਾ ਆਇਲ ਤਾਂ ਇਹਦੇ 'ਤੇ ਹੈਗਾ ਆ ਅਤੇ ਅਸੀਂ ਮੱਖਣ ਫਿਸ਼ ਤੋਂ ਮਹਿੰਗੀ ਫਿਸ਼ ਇਸ ਕਰਕੇ ਮੰਗਵਾਈ ਸੀ ਕਿ ਉਹਦੀ ਕੁਆਲਿਟੀ ਬੜੀ ਅੱਛੀ ਆ ਇਹ ਤਾਂ ਬਿਲਕੁਲ ਬੇਕਾਰ ਫਿਸ਼ ਆ ਅਤੇ ਅਸੀਂ ਇਹਨੂੰ ਵਾਪਿਸ ਕਰੋ ਅਸੀਂ ਇਹਨੂੰ ਨਹੀਂ ਰੱਖਣਾ ਨਾ ਅਸੀਂ ਸਾਡੇ ਕੋਲ ਖਾਦੇ ਨਹੀਂ ਜਾਣੀ ਅਸੀਂ ਓਇਲੀ ਤਾਂ ਵੈਸੇ ਨਹੀਂ ਸਾਨੂੰ ਪਸੰਦ ਆ ਪਸੰਦ ਜ਼ਿਆਦਾ ਓਇਲੀ ਵੈਸੇ ਅਸੀਂ ਸੰਘਾੜਾ ਫਿਸ਼ ਦੇ ਦੇ ਆ ਅਤੇ ਦੇਣ ਤੁਸੀਂ ਸਾਨੂੰ ਉਹ ਡੇ ਡੇ ਹੋ ਪਿਆਸੀ ਅਸੀਂ ਤਾਂ ਨਾਮ ਸੁਣ ਕੇ ਨਾਮ ਦੇ ਅਕੋਰਡਿੰਗ ਮੰਗਵਾਇਆ ਸੀ ਅਤੇ ਪਰ ਨਹੀਂ ਭਾਅ ਜੀ ਇਹ ਨੂੰ ਵਾਪਸ ਕਰੋ ਅਸੀਂ ਨਹੀਂ ਲੈਣੀ ਇਹ ਇਹਨੂੰ ਰਿਪਲੇਸ ਕਰਕੇ ਦਿਓ ਜਾਂ ਕੁਆਂਟਿਟੀ ਪੂਰੀ ਕਰਕੇ ਦਿਓ ਸਾਨੂੰ ਇਹ ਜਲਦੀ ਕਰ ਦਿਓ ਬ ਸਾਡੀ ਬੇਇੱਜ਼ਤੀ ਕਰਾ ਛੱਡੀ ਤੁਸੀਂ ਯਾਰਾਂ ਦੋਸਤਾਂ ਅੱਗੇ